ਹਾਂ ਮੈਂ ਅਕੇਲੇ ਸਫਰ ਕੀਤਾ ਹੈ ਜਿੱਥੇ ਕਿ ਮੈਂ ਆਪਣੀ ਦੋਸਤ ਕੋਲ ਰਹਿਣ ਗਈ ਸੀ ਚੰਡੀਗੜ੍ਹ ਅਤੇ ਮੈਂ ਬੱਸ ਰਾਹੀਂ ਗਈ ਸੀ ਅਤੇ ਉਹ ਅਨੁਭਵ ਵਧੀਆ ਸੀ ਸਾਨੂੰ ਸਾਰਿਆਂ ਨੂੰ ਆਪਣੇ ਲਈ ਵੀ ਥੋੜ੍ਹਾ ਟਾਈਮ ਕੱਢਣਾ ਚਾਹੀਦਾ ਅਤੇ ਆਪਣੇ ਲਈ ਵੀ ਥੋੜ੍ਹਾ ਟਾਈਮ ਦੇਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਜ਼ਿੰਦਗੀ ਵੀ ਇਕੱਲੇ ਰਹਿ ਕੇ ਇੱਕ ਵਾਰ ਸਾਰਿਆਂ ਨੂੰ ਜੀਣੀ ਚਾਹੀਦੀ ਹੈ ਮੈਂ ਆਪਣੀ ਦੋਸਤ ਕੋਲ ਗਈ ਸੀ ਚੰਡੀਗੜ੍ਹ ਅਤੇ ਮੈਂ ਅਕੇਲੇ ਹੀ ਸਫਰ ਕੀਤਾ ਸੀ ਛੇ ਸੱਤ ਘੰਟੇ ਬੱਸ 'ਚ ਅਤੇ ਇਕੱਲੇ ਰਹਿ ਕੇ ਵੀ ਸਾਨੂੰ ਖੁਸ਼ ਰਹਿਣਾ ਚਾਹੀਦਾ ਅਤੇ ਮੈਂ ਉਸ ਕੋਲ ਗਈ ਸੀ ਚੰਡੀਗੜ ਜਦੋਂ ਉਹ ਮੈਨੂੰ ਮਿਲੀ ਸੀ ਉਹ ਵੀ ਬਹੁਤ ਖੁਸ਼ ਸੀ ਕਿਸ ਅਸੀਂ ਇੰਨੇ ਚਿਰ ਬਾਅਦ ਇਕੱਠੇ ਹੋਏ ਹਨ ਇਹ ਗੱਲ ਸੱਚ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਇੱਕ ਮੌਕਾ ਦੇਣਾ ਚਾਹੀਦਾ ਬਟ ਅਸੀਂ ਇਹ ਬਿਜ਼ੀ ਸ਼ਡਿਊਲ ਤੋਂ ਨਹੀ ਦੇ ਪਾ ਰਹੇ ਸਨ ਕਿ ਆਪਣੇ ਆਪ ਦੀ ਵੀ ਜ਼ਿੰਦਗੀ ਸਾਨੂੰ ਜੀਣੀ ਚਾਹੀਦੀ ਹੈ ਬਟ ਕਦੇ ਫੈਮਲੀ ਨਾਲ ਹੋ ਗਿਆ ਕਦੇ ਦੋਸਤਾਂ ਨਾਲ ਹੋ ਗਿਆ ਅਕੇਲੇ ਸਾਨੂੰ ਟਰੈਵਲ ਕਰਨ ਦਾ ਬਹੁਤ ਹੀ ਘੱਟ ਮੌਕਾ ਮਿਲਿਆ ਅਤੇ ਸਾਨੂੰ ਸਾਰਿਆਂ ਨੂੰ ਇਹ ਮੌਕਾ ਨਹੀਂ ਖੋਣਾ ਚਾਹੀਦਾ ਅਤੇ ਕਦੇ ਆਪਣੇ ਲਈ ਵੀ ਥੋੜ੍ਹਾ ਟਾਈਮ ਕੱਢਣਾ ਚਾਹੀਦਾ ਹੈ ਅਤੇ ਸਾਨੂੰ ਇਕੱਲੇ ਵੀ ਸਫਰ ਕਰਨਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਕੱਲੇ ਵੀ ਸਫਰ ਅਸੀਂ ਕਰ ਸਕਦੇ ਹਾਂ ਅਤੇ ਆਪਣੇ ਲਈ ਵੀ ਟਾਈਮ ਦੇਣਾ ਬਹੁਤ ਜ਼ਰੂਰੀ ਹੈ